ਮੇਰਾ ਇੱਕ ਛੋਟਾ ਭਰਾ ਹੈ ਜੋ ਮੇ ਮੇਰੇ ਕੋਲੋਂ ਸੁਭਾਅ ਵਿੱਚ ਕਾਫੀ ਜੋ ਬਦਲਾਅ ਰੱਖਦਾ ਹੈ ਕਿਉਂਕਿ ਹਰ ਇੱਕ ਬੰਦੇ ਦਾ ਆਪਣਾ ਸੁਭਾਅ ਆਪਣੀ ਸੋਚਣੀ ਆਪਣੇ ਤੌਰ ਤਰੀਕੇ ਹੁੰਦੇ ਹਨ ਮੇਰਾ ਜੋ ਭਰਾ ਹੈ ਉਹ ਕਾਫੀ ਜੋ ਮੇਰੇ ਤੋਂ ਸ਼ਕਤੀ ਵਿੱਚ ਵੀ ਭਲਵਾਨ ਹੈ ਅਤੇ ਥੋੜ੍ਹਾ ਗਰਮ ਸੁਭਾਅ ਦਾ ਜੋ ਮਾਲਕ ਹੈ ਮੈਂ ਖੁਦ ਨਿੱਜੀ ਤੌਰ 'ਤੇ ਕਾਫੀ ਸ਼ਾਂਤ ਰਹਿਣ ਵਾਲਾ ਵਿਅਕਤੀ ਹਾਂ ਅਤੇ ਜੋ ਸਾਹਿਤ ਜਾਂ ਖੇਡਾਂ ਪ੍ਰਤੀ ਦਿਲਚਸਪੀ ਰੱਖਦਾ ਹਾਂ ਪਰ ਜੋ ਮੇਰਾ ਛੋਟਾ ਭਰਾ ਹੈ ਉਸ ਨੂੰ ਖੇਡਾਂ ਪ੍ਰਤੀ ਘੱਟ ਹੀ ਦਿਲਚਸਪੀ ਹੈ ਉਹ ਜ਼ਿਆਦਾਤਰ ਫੋਨ ਜੋ ਹੈ ਦੇਖਣ ਵਿੱਚ ਕਾਫੀ ਦਿਲਚਸਪੀ ਰੱਖਦਾ ਹੈ ਫੋਨ ਦੇਖਣਾ ਚੰਗੀ ਗੱਲ ਹੈ ਪਰ ਜ਼ਿਆਦਾ ਦੇਖਣਾ ਮਾੜੀ ਗੱਲ ਹੈ ਕਿਉਂਕਿ ਵਾਰ ਵਾਰ ਜਦੋਂ ਆਪਾਂ ਫੋਨ ਦੇਖਦੇ ਹਾਂ ਆਪਾਂ ਪੜ੍ਹਾਈ ਤੋਂ ਧਿਆਨ ਹਟਾਉਂਦੇ ਹਾਂ ਅਤੇ ਸਾਡਾ ਪੜ੍ਹਾਈ ਵਿੱਚ ਵੀ ਕਾਫੀ ਘਾਟਾ ਹੁੰਦਾ ਹੈ